ਮੈਂ ਆਪਣੇ ਚਿੱਤਰਾਂ ਨੂੰ ਇਸ ਤਰ੍ਹਾਂ ਬਚਾ ਕੇ ਰੱਖਦੀ ਹੈਗੀ ਜਿਵੇਂ ਕਿ ਮੈਂ ਜਿਹੜੇ ਚਿੱਤਰ ਪੇਂਟ ਕਰ ਕਰਕੇ ਰੱਖ ਦਿੰਦੀ ਹੈਗੀ ਉਹਨਾਂ ਨੂੰ ਪੂਰੇ ਤਰੀਕੇ ਨਾਲ ਕਵਰ ਕਰਕੇ ਰੱਖਦੀ ਹਾਂ ਵੀ ਕਿਉਂਕਿ ਜਿਹੜੇ ਧੂੜ ਮਿੱਟੀ ਹੈ ਨਾ ਉਹਨਾਂ ਦੇ ਉੱਤੇ ਨਾ ਪਵੇ ਅਤੇ ਉਹਨਾਂ ਨੂੰ ਮੈਂ ਕਦੇ ਲੇਮੀਲੇਟ ਕਰ ਦਿੰਦੀ ਹੈਗੀ ਫ੍ਰੇਮੀ ਕਰ ਦਿੰਦੀ ਹੈਗੀ ਮੋਮ ਕੁਟਿੰਗ ਕਰ ਦਿੰਦੀ ਹੈਗੀ ਕਿਉਂਕਿ ਵੀ ਜਿਹੜੀ ਪੇਂਟਿੰਗ ਹੈਗੀ ਉਹ ਮੇਰੀ ਖਰਾਬ ਨਾ ਹੋਵੇ ਅਤੇ ਉਹਨਾਂ ਨੂੰ ਮੈਂ ਪੇਟ ਕਰ ਕਰਕੇ ਆਪਣੇ ਰੂਮ ਦੇ ਵਿੱਚ ਲਗਾਏ ਹੋਏ ਹੈਗੇ ਮੈਂ ਨਾ ਪੂਰੇ ਸਹੀ ਤਰੀਕੇ ਨਾਲ ਕਵਰ ਕਰਕੇ ਲੇਮੀਲੇਟ ਕਰਕੇ ਪੂਰੇ ਪੂਰੇ ਲਗਾਏ ਹੋਏ ਪੂਰੇ ਤਰੀਕੇ ਨਾਲ ਲਗਾਏ ਹੋਏ ਨੇ ਕੰਧਾਂ ਦੇ ਉੱਤੇ ਵੀ ਕਿਉਂਕਿ ਜਿਹੜੀ ਸਾਡੇ ਬੱਚੇ ਛੋਟੇ ਛੋਟੇ ਬੱਚੇ ਹੈਗੇ ਉਹ ਖਰਾਬ ਨਾ ਕਰ ਦੇਣ ਉਹਨਾਂ ਨੂੰ ਇਸ ਲਈ ਮੈਨੂੰ ਪੂਰੇ ਤਰੀਕੇ ਨਾਲ ਕਵਰ ਕੀਤੇ ਹੋਏ ਨੇ ਉਹ ਉੱਚੀ ਉੱਚੀ ਥਾਵਾਂ 'ਤੇ ਲਗਾਏ ਹੋਏ ਹੈਗੇ ਵੀ ਕਿਉਂਕਿ ਉਹ ਖਰਾਬ ਨਾ ਹੋ ਜਾਏ ਸਾਰੀ ਪੇਂਟਿੰਗ ਮੇਰੀ ਇਸ ਲਈ ਇਸ ਤਰ੍ਹਾਂ ਮੈਂ ਆਪਣੇ ਚਿੱਤਰਾਂ ਨੂੰ ਬਚਾ ਕੇ ਰੱਖਦੀ ਹਾਂ